ਲੋਹੜੀ ਦਾ ਤਿਉਹਾਰ ਸਾਡੇ ਬਹੁਤ ਵਧੀਆ ਪ੍ਰੇਮ ਪ੍ਰੇਮ ਨਾਲ ਮਨਾਇਆ ਜਾਂਦਾ ਹੈ ਜਦੋਂ ਬੱਚੇ ਦੀ ਲੋਹੜੀ ਮਨਾਈ ਜਾਂਦੀ ਹੈ ਉਦੋਂ ਆਂਢ ਗੁਆਂਢ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਸਾਰੇ ਲੋਕ ਇਕੱਠੇ ਹੋ ਕੇ ਬੱਚੇ ਦੀ ਲੋਹੜੀ ਮਨਾਉਂਦੇ ਹਨ ਅਤੇ ਇੱਦਾਂ ਹੀ ਕੁੜੀ ਦੀ ਆਪਣਾ ਲੋਹੜੀ ਮਨਾਈ ਜਾਂਦੀ ਹੈ ਸਾਰੇ ਆਂਢ ਗੁਆਂਢ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਇਕੱਠੇ ਹੋ ਜਾਂਦੇ ਜਦੋਂ ਲੋਕ ਅਤੇ ਉੱਦੂ ਬਾਅਦ ਲੋਹੜੀ ਮਨਾਈ ਜਾਂਦੀ ਹੈ ਅਤੇ ਆਪਣਾ ਮੂੰਗਫਲੀਆਂ ਰਿਉੜੀਆਂ ਵੰਡੀਆਂ ਜਾਂਦੀਆਂ ਅਤੇ ਦਿਵਾਲੀ ਦਾ ਤਿਉਹਾਰ ਸਾਡੇ ਲੋਕ ਸੁਬਹਾ ਨੂੰ ਨਹਾ ਧੋ ਕੇ ਗੁਰਦੁਆਰਾ ਸਾਹਿਬ ਜਾਂਦੇ ਹੈ ਇਸ਼ਨਾਨ ਵਗੈਰਾ ਕਰਦੇ ਹੈ ਅਤੇ ਉੱਥੇ ਆਪਣੇ ਜੋ ਵੀ ਪੂਜਾ ਪਾਠ ਹੁੰਦੀ ਹੈ ਉਹ ਕਰਾ ਕੇ ਆ ਆਉਂਦੇ ਹੈ ਅਤੇ ਉਸ ਤੋਂ ਬਾਅਦ ਬੱਚੇ ਬੱਚਿਆਂ ਨੂੰ ਨਾਲ ਲਿਜਾ ਕੇ ਪਟਾਕੇ ਵਗੈਰਾ ਮਿਠਾਈਆਂ ਵਗੈਰਾ ਪਰਿਵਾਰ ਨਾਲ ਸ਼ਹਿਰ ਲੈ ਕੇ ਜਾਂਦੇ ਹੈ ਅਤੇ ਉੱਥੋਂ ਲਿਆ ਕੇ ਉੱਦੂ ਬਾਅਦ ਸ਼ਾਮ ਨੂੰ ਉਹ ਦੇਵੀ ਦੇਵਤਿਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਜੋ ਦੇਵੀ ਦੇਵਤਾ ਮੰਨਦੇ ਹਨ ਅਤੇ ਸ਼ਾ ਉੱਦੂ ਬਾ ਪਟਾਕੇ ਚਲਾਏ ਜਾਂਦੇ ਆ ਮਿਠਾਈਆਂ ਵੰਡੀਆਂ ਜਾਂਦੀਆਂ ਹਨ ਲੋਕ ਨਵੇਂ ਕੱਪੜੇ ਪਾਉਂਦੇ ਤਾਂ ਜੋ ਆਪਣਿਆਂ ਮ ਤਾਂ ਜੋ ਖੁਸ਼ੀ ਦਾ ਤਿਉਹਾਰ ਚੰਗੀ ਤਰ੍ਹਾਂ ਮਨਾਇਆ ਜਾ ਸਕੇ ਅਤੇ ਇੱਦਾਂ ਹੀ ਆਪਣਾ ਸਾਡੇ ਮਾਘੀ ਦਾ ਤਿਉਹਾਰ ਹੈ ਜਦੋਂ ਮੇਲਾ ਲੱਗਦਾ ਹੈ ਕਿਤੇ ਸਾਰੇ ਲੋਕ ਇਕੱਠੇ ਹੋ ਜਾਂਦੇ ਹੈ ਅਤੇ ਉੱਥੇ ਜਾਂਦੇ ਇਕੱਠੇ ਹੋ ਕੇ ਬਜ਼ਾਰਾਂ ਲੱਗੀਆਂ ਹੁੰਦੀਆਂ ਹੈ ਰੋਕ ਲੋਕ ਵਧੀਆ ਨੱਚਦੇ ਟੱਪਦੇ ਉੱਥੇ ਕੋਈ ਆਪਣਾ ਕਿੱਧਰ ਨੂੰ ਜਾਂਦਾ ਕੋਈ ਕਿੱਧਰ ਜਾ ਕੋਈ ਆਪਣਾ ਆਪਣਾ ਖਰੀਦ ਸਮਾਨ ਸਮੂਨ ਵਗੈਰਾ ਖਰੀਦਦਾ ਹੈ ਕਿੱਧਰੇ ਕੁਛ ਕਰਦਾ ਕੋਈ